ਹੈਲੋ ਹਾਂਜੀ ਬਾਈ ਜੀ ਮੈਂ ਅਨੀਤਾ ਬੋਲ ਰਹੀ ਹਾਂ ਮੈਨੂੰ ਪਹਿਚਾਣ ਲਿਆ ਹਾਂਜੀ ਹਾਂਜੀ ਹਾਂਜੀ ਬਾਈ ਜੀ ਇੱਕ ਨਾ ਮੈਂ ਤੁਹਾਨੂੰ ਗੱਲ ਦੱਸਣੀ ਸੀ ਬਹੁਤ ਹੀ ਜ਼ਿਆਦਾ ਮੈਂ ਪਰੇਸ਼ਾਨ ਚੱਲ ਰਹੀ ਹਾਂ ਵੀ ਆਪਾਂ ਇੱਥੇ ਨਾ ਨਰਮਾ ਬੀਜਿਆ ਹੋਇਆ ਸੀ ਅਤੇ ਹੁਣ ਹੋਇਆ ਕੀ ਵੀ ਇੱਕ ਤਾਂ ਨਰਮੇ ਦੇ ਜੋ ਮੌਸਮ ਇਕਦਮ ਖ਼ਰਾਬ ਹੋਇਆ ਉਸ ਦੇ ਕਰਕੇ ਫ਼ਸਲ ਨੂੰ ਬਹੁਤ ਮਾਰ ਪੈ ਗਈ ਏ ਅਤੇ ਹੁਣ ਉੱਪਰੋਂ ਇੱਕ ਦਮ ਠੰਡ ਵੱਧ ਗਈ ਹੋਈ ਏ ਅਤੇ ਠੰਡ ਵਧਣ ਨਾਲ ਵੀ ਉਹ ਬਹੁਤ ਜ਼ਿਆਦਾ ਫ਼ਸਲ ਨੂੰ ਨੁਕਸਾਨ ਹੋ ਗਿਆ ਏ ਅਤੇ ਮੈਨੂੰ ਪਤਾ ਲੱਗਿਆ ਹੈ ਕਿ ਜੇ ਇੱਕ ਸਮੇਂ ਸੀਮਾ ਦੇ ਵਿੱਚ ਜੇ ਆਪਾਂ ਉਹਨੂੰ ਕਿੱਧਰੇ ਅਪਲਾਈ ਕਰ ਸਕੀਏ ਤਾਂ ਜੋ ਆਪਾਂ ਨੂੰ ਉਹਦਾ ਕੋਈ ਬੀਮੇ ਦਾ ਮੁਆਵਜ਼ਾ ਮਿਲ ਸਕੇ ਅਤੇ ਉਸ ਦਾ ਮੈਨੂੰ ਤਜਰਬਾ ਨਹੀਂ ਹੈ ਤਾਂ ਤੁਸੀਂ ਮੈਨੂੰ ਥੋੜ੍ਹਾ ਜਿਹਾ ਉਸਦੀ ਜਾਣਕਾਰੀ ਦਿਓ ਮੈਂ ਆਨਲਾਈਨ ਪਤਾ ਕੀਤਾ ਸੀ ਆਨਲਾਈਨ ਵੈਬਸਾਈਟ ਚੈੱਕ ਕਰੀ ਸੀ ਪਰ ਮੈਨੂੰ ਕੋਈ ਗੱਲ ਸਮਝ ਨਹੀਂ ਆਈ ਅਤੇ ਪਲੀਸ ਤੁਸੀਂ ਮੈਨੂੰ ਇਹਦੀ ਜਾਣਕਾਰੀ ਭੇਜ ਦਿਓ ਤਾਂ ਜਾਂ ਭਾਵੇਂ ਮੈਨੂੰ ਵਟਸਅਪ ਕਰ ਦਿਓ ਜਾਣਕਾਰੀ ਮੈਂ ਉਹ ਦੇਖ ਲਵਾਂਗੀ